ਵੈਸੇ ਮੈਨੂੰ ਤਾਂ ਪੰਜਾਬੀ ਗਾਣੇ ਬਹੁਤ ਪਸੰਦ ਹਾਂ ਪਰ ਇਸ ਦੇ ਕੁਛ ਬੁਰੇ ਪੱਖ ਵੀ ਹਨ ਜੋ ਪੰਜਾਬੀ ਸੱਭਿਆਚਾਰ ਨੌਜਵਾਨੀ ਅਤੇ ਸਮਾਜ 'ਤੇ ਮਾੜਾ ਪ੍ਰਭਾਵ ਪਾ ਰਹੀਆਂ ਹਨ ਜਿਵੇਂ ਕਿ ਪੰਜਾਬੀ ਗਾਇਕ ਦੇ ਬੁਰੇ ਪੱਖ ਜਿਵੇਂ ਕਿ ਹਿੰਸਾ ਗੁੰਡਾਗਰਦੀ ਅਤੇ ਹਥਿਆਰਾਂ ਦੀ ਪ੍ਰਮੋਟ ਕਰਨਾ ਅੱਜ ਕੱਲ੍ਹ ਦੇ ਬਹੁਤ ਗਾਣੇ ਹਿੰਸਾ ਗੁੰਡਾਗਰਦੀ ਅਤੇ ਗੈਂਗਸਟਰਾਂ ਨੂੰ ਵਾਧਾ ਦੇ ਰਹੇ ਹਨ ਨੌਜਵਾਨ ਇਹਨਾਂ ਗੀਤਾਂ ਨੂੰ ਹੁਨਰ ਦੀ ਥਾਂ ਹਕੀਕਤ ਮੰਨ ਲੈਂਦੇ ਹਨ ਜਿਵੇਂ ਕਿ ਨਸ਼ਿਆਂ ਨੂੰ ਪ੍ਰਮੋਟ ਕਰਨਾ ਪੰਜਾਬੀ ਗਾਇਕ 'ਚ ਸ਼ਰਾਬ ਨਸ਼ਿਆਂ ਦੀਆਂ ਗੱਲਾਂ ਬਹੁਤ ਆ ਰਹੀਆਂ ਹਨ ਨੌਜਵਾਨ ਵਿੱਚ ਗਲਤ ਰੁਝਾਨ ਅਪਣਾਉਣ ਲੱਗ ਪਏ ਹਨ ਇਹ ਪੰਜਾਬ 'ਚ ਨਸ਼ੇ ਸਮੱਸਿਆ ਨੂੰ ਹੋਰ ਵਧਾ ਰਿਹਾ ਹੈ ਪੰਜਾਬੀ ਗਾਣੇ ਵਿੱਚ ਔਰਤ ਦਾ ਗਲਤ ਦਿਖਾਵਟ ਕੀਤੀ ਜਾਂਦੀ ਹੈ ਜਿਸ ਕਾਰਨ ਅੱਜ ਕੱਲ੍ਹ ਸਮਾਜ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਪੁਰਾਣੇ ਪੰਜਾਬੀ ਸੱਭਿਆਚਾਰ ਨੂੰ ਅਣਦੇਖਾ ਕੀਤਾ ਜਾਂਦਾ ਹੈ ਪੰਜਾਬੀ ਗਾਇਕਾਂ ਨੂੰ ਠੀਕ ਕਰਨ ਲਈ ਸਹੀ ਟੈਲੇਂਟ ਨੂੰ ਅੱਗੇ ਲਿਆਉਣਾ ਚਾਹੀਦਾ ਹੈ ਅਸਲ ਤਰੀਕੇ ਨਾਲ ਗਾਉਣ ਵਾਲਿਆਂ ਨੂੰ ਸਹਿ ਮਚ ਮ ਮਿਲਣੇ ਚਾਹੀਦੇ ਹਨ ਲੋਕ ਸੰਗੀਤ ਗੁਣਵਤਾ ਵਾਲੇ ਗੀਤ ਅਤੇ ਵਿਰਾਸਤੀ ਗਾਇਕ ਨੂੰ ਫਿਰ ਤੋਂ ਉਚਾਇਆ ਲੈ ਜਾਣਾ ਚਾਹੀਦਾ ਹੈ ਹਿੰਸਾ ਗੁੰਡਾਗਰਦੀ ਅਤੇ ਨਸ਼ਿਆਂ ਵਾਲੇ ਗੀਤਾਂ 'ਤੇ ਰੋਕ ਲਾਉਣੀ ਚਾਹੀਦੀ ਹੈ ਔਰਤ ਦਾ ਸਹੀ ਦ੍ਰਿਸਵਾਟ ਕਰਨਾ ਚਾਹੀਦਾ ਹੈ ਧੰਨਵਾਦ ਜੀ